ਹੈਲੋ ਹਾਂਜੀ ਮੈਂ ਮਨੀਸ਼ਾ ਬੋਲਦੀ ਕਪੂਰਥਲੇ ਤੋਂ ਮੈਂ ਇੱਕ ਡਰੈਸ ਮੰਗਵਾਈ ਸੀ ਤੁਹਾਡੀ ਐਪ ਤੋਂ ਨਾ ਔਨਲਾਈਨ ਮਤਲਬ ਕਿ ਪ ਖਰੀਦੀ ਹੈ ਪਰ ਜਿਹੜਾ ਰੰਗ ਮੈਂ ਦੇਖਿਆ ਔਨਲਾਈਨ ਡਰੈਸ ਦਾ ਉਹ ਕਲ ਉਹ ਰੰਗ ਹੈ ਹੀ ਨਹੀਂ ਇਹ ਕੋਈ ਹੋਰ ਹੀ ਆ ਗਿਆ ਹੈ ਹੁਣ ਤੁਸੀਂ ਮੈਨੂੰ ਦੱਸ ਦਿਓ ਕਿ ਇਹਦਾ ਕੀ ਤਰੀਕਾ ਹੈ ਨਾ ਕਿ ਮੈਂ ਕਿਵੇਂ ਡਰੈਸ ਜਾਂ ਤਾਂ ਤੁਸੀਂ ਮੈਨੂੰ ਪੈਸੇ ਰਿਫੰਡ ਕਰਦੋਂਗੇ ਜਾਂ ਤੁਸੀਂ ਮੈਨੂੰ ਤਿੰਨ ਦਿਨਾਂ ਦੇ ਅੰਦਰ ਜਿਹੜਾ ਜਿਹੜਾ ਰੰਗ ਮੈਂ ਦੇਖਿਆ ਡਰੈਸ ਦਾ ਤੁਸੀਂ ਮੈਨੂੰ ਉਹ ਭੇਜ ਦੋਂਗੇ ਹਾਂਜੀ ਰੰਗ ਭੇਜ ਦੋਂਗੇ ਸਹੀ ਅਗਰ ਤਾਂ ਤੁਸੀਂ ਮੈਨੂੰ ਤਿੰਨ ਦੇ ਅੰਦਰ ਅੰਦਰ ਭੇਜ ਸਕਦੇ ਓਂ ਫੇਰ ਤਾਂ ਠੀਕ ਹੈ ਨਹੀਂ ਤਾਂ ਮੇਰੇ ਪੈਸੇ ਮੈਨੂੰ ਵਾਪਿਸ ਕਰ ਦਿਓ ਓਕੇ ਡਰੈਸ ਦਾ ਸਹੀ ਰੰਗ ਭੇਜ ਸਕਦੇ ਹੋ ਠੀਕ ਹੈ ਠੀਕ ਹੈ ਜੀ